ਟੈਕਨੋਲੋਜੀ ਨੇ ਬਹੁਤ ਵਧੀਆ ਹੈਲਪ ਕੀਤੀ ਹੈ ਜਵਾਨਾ ਵਾਸਤੇ ਤੁਸੀਂ ਬਜ਼ੁਰਗਾਂ ਨੂੰ ਲੈ ਲਓ ਦ੍ਰਿਸ਼ਟੀਹੀਨ ਨੂੰ ਲੈ ਲਓ ਬਜ਼ੁਰਗ ਜਿਹੜੇ ਚੱਲ ਨਹੀਂ ਸਕਦੇ ਉਹਨਾਂ ਵਾਸਤੇ ਅੱਜ ਕੱਲ ਇੰਨੀ ਵਧੀਆ ਵੀਲ ਚੇਅਰਸ ਆ ਗਈਆਂ ਬੈਟਰੀ ਵਾਲੀਆਂ ਆ ਗਈਆਂ ਜਾਂ ਜਿਹੜੇ ਬਜ਼ੁਰਗਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਗੋਡਿਆਂ ਦੀ ਇਨੀ ਵਧੀਆ ਟਕਨੀਕ ਆ ਗਈ ਕਿ ਉਹਨਾਂ ਦੇ ਗੋਡੇ ਹੀ ਬਦਲ ਦਿੰਦੇ ਆ ਦ੍ਰਿਸ਼ਟੀਹੀਨ ਵਾਸਤੇ ਲੈ ਲਓ ਕਿ ਉਹਨਾਂ ਦੀ ਜਿਹੜੀ ਸਟ੍ਰਿਕਸ ਹੁੰਦੀ ਹ ਉਹਨਾਂ ਦੇ ਵਿੱਚ ਇਦਾਂ ਦੇ ਸੈਂਸਰ ਲੱਗੇ ਹੁੰਦੇ ਆ ਕਿ ਉਹਨਾਂ ਨੂੰ ਪਹਿਲੇ ਅਲਰਟ ਕਰ ਦਿੰਦੀਆਂ ਬੀ ਮਾਈ ਬੀ ਮਾਈ ਆਈਜ ਐਬ ਜਿਹੜੀ ਕਿ ਇੰਨੀ ਵਧੀਆ ਹੈਲਪਫੁਲ ਹੈ ਕਿ ਜੋ ਕੁਝ ਉਹ ਬੋਲ ਰਿਹਾ ਕਿ ਉਹੀ ਉਹ ਲਿਖ ਦਿੰਦੀਆਂ ਨੇ ਜਾਂ ਜੋ ਕੋਈ ਮੈਸੇਜ ਦੂਜੇ ਪਾਸੇ ਉਹ ਆਇਆ ਉਹੀ ਉਹਨਾਂ ਨੂੰ ਬੋਲ ਕੇ ਸੁਣਾ ਦਿੰਦੀ ਹੈ ਟੈਕਨੋਲੋਜੀ ਨੇ ਬਹੁਤ ਜਿਆਦਾ ਚੇਂਜ ਲਿਆ ਤਾ